ਮੇਰਾ ਨਾਮ ਸਿਮਰਨ ਹੈ ਮੈਂ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਅਤੇ ਸੋ ਮੇਰਾ ਤਬਾਦਲਾ ਹੁਣ ਅੰਮ੍ਰਿਤਸਰ ਹੋ ਗਿਆ ਹੈ ਪਹਿਲਾਂ ਮੈਂ ਗੁਰਦਾਸਪੁਰ ਜੋਬ ਕਰਦੀ ਸੀ ਹੁਣ ਮੇਰਾ ਤਬਾਦਲਾ ਅੰਮ੍ਰਿਤਸਰ ਹੋ ਗਿਆ ਆ ਅਤੇ ਸੋ ਕਿਰਪਾ ਕਰਕੇ ਮੇਰੀ ਜਿਹੜੀ ਗੈਸ ਦੀ ਕਾਪੀ ਹੈ ਉਹ ਇੱਥੇ ਬਦਲੀ ਕੀਤੀ ਜਾਵੇ ਕਿਉਂਕਿ ਮੈਨੂੰ ਅੰਮ੍ਰਿਤਸਰ ਤੋਂ ਗੁਰਦਾਸਪੁਰ ਗੈਸ ਲੈਣ ਜਾਣ ਵਾਸਤੇ ਜਾਣਾ ਪੈਂਦਾ ਹੈ ਸੋ ਔਖਾ ਹੈ ਮੈਨੂੰ ਸੋ ਬੇਨਤੀ ਕੀਤੀ ਜਾਂਦੀ ਹੈ ਕਿ ਮੈਂ ਤੁਹਾਨੂੰ ਆਪਣਾ ਅਡਰੈਸ ਦੱਸ ਦੇਵਾਂਗੀ ਅਤੇ ਸੋ ਮੇਰਾ ਜਿਹੜਾ ਗੈਸ ਅਜੈਂਸੀ ਕਾਪੀ ਹੈ ਉਹ ਬਦਲੀ ਕੀਤੀ ਜਾਵੇ ਕਿਉਂਕਿ ਮੈਨੂੰ ਖਾਣਾ ਬਣਾਉਣ ਵਿੱਚ ਮੁਸ਼ਕਿਲ ਆ ਰਹੀ ਹੈ ਮੈਂ ਚਾਰ ਪੰਜ ਦਿਨ ਤੋਂ ਇੱਥੇ ਸ਼ਿਫਟ ਹੋਈ ਹਾਂ ਅਤੇ ਇਸ ਕਰਕੇ ਜਲਦੀ ਤੋਂ ਜਲਦੀ ਮੇਰੀ ਗੈਸ ਕਾਪੀ ਚੇਂਜ ਕੀਤੀ ਜਾਵੇ ਮੈਂ ਆਪਣਾ ਅਡਰੈਸ ਤੁਹਾਨੂੰ ਦੇ ਦੇਵਾਂਗੀ ਅਤੇ ਸੋ ਬੇਨਤੀ ਹੈ ਇੱਕ ਵਾਰੀ ਫਿਰ ਕਿ ਮੇਰਾ ਨਾਮ ਸਿਮਰਨ ਹੈ ਮੈਂ ਤੁਹਾਨੂੰ ਅਡਰੈਸ ਦੇ ਦੇਵਾਂਗੀ ਤੋ ਸੋ ਮੇਰੀ ਕਾਪੀ ਜਲਦੀ ਤੋਂ ਜਲਦੀ ਅਡਰੈਸ 'ਤੇ ਚੇਂਜ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ